ਹੈਲੋ ਕੀ ਤੁਸੀਂ ਬਰਗਰ ਬਾਇਟ ਤੋਂ ਗੱਲ ਕਰ ਰਹੇ ਹੋ ਮੈਨੂੰ ਆਪਣੇ ਪਰਿਵਾਰ ਦੇ ਲਈ ਸ਼ਾਮ ਦੇ ਖਾਣੇ ਦਾ ਆਰਡਰ ਦੇਣਾ ਸੀ ਇਸ ਵਿੱਚ ਤੁਸੀਂ ਚਪਾਤੀ ਦਾਲ ਮੱਖਣੀ ਕੜਾਹੀ ਪਨੀਰ ਅਤੇ ਨਾਲ ਹੀ ਮਿੱਠੇ ਵਿੱਚ ਗੁਲਾਬ ਜਾਮੁਣ ਕਰ ਦਿਓ ਅਤੇ ਇਹ ਸਾਰਾ ਖਾਣਾ ਤੁਸੀਂ ਮੇਰੇ ਐਡਰੈੱਸ ਪਾਵਰ ਕਲੋਨੀ ਤਿੰਨ ਸੌ ਸਤਾਈ ਕਵਾਟਰ ਨੰਬਰ ਵਿੱਚ ਭੇਜ ਦਿਉ ਅਤੇ ਇਹ ਸਾਰੇ ਖਾਣੇ ਦਾ ਜਿੰਨਾਂ ਵੀ ਬਿੱਲ ਬਣੇਗਾ ਉਹ ਸਾਰਾ ਤੁਹਾਨੂੰ ਮੈਂ ਜਦੋਂ ਖਾਣਾ ਡਿਲੀਵਰ ਹੋਜੇਗਾ ਉਸ ਦੇ ਨਾਲ ਹੀ ਦੇ ਦੇਵਾਂਗੀ